ਮੈਂ ਖੁਦ ਤਜਰਬਾ ਨਹੀਂ ਕਰ ਸਕਦਾ ਪਰ ਮੌਸਮ ਦੀ ਸ਼ੂਟਿੰਗ ਦੁਨੀਆ ਬਹੁਤ ਦਿਲਚਸਪ ਹੈ ਮੌਸਮ ਦੇ ਫੂ ਮੂਡ ਅਤੇ ਮਾਹੌਲ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ ਉਦਾਹਰਨ ਬਰਫੀਲੀ ਮੌਸਮ ਵਿਚ ਸਾਰੀਆਂ ਚੀਜ਼ਾਂ ਸਾਫ ਤੇ ਖੂਬਸੂਰਤ ਹੁੰਦੀਆਂ ਹਨ ਜੇ ਇੱਕ ਠੰਡੀ ਅਤੇ ਸ਼ਾਂਤ ਮਾਹੌਲ ਬਣਾਉਂਦਾ ਹੈ ਜੋ ਇਕ ਠੰ ਇੱਕ ਠੰਡੀ ਅਤੇ ਸ਼ਾਂਤ ਮਾਹੌਲ ਬਣਾਉਂਦਾ ਜਦੋਂ ਮੀਹ ਜਾਂ ਧੁੰਦ ਹੁੰਦੀ ਹੈ ਤਾਂ ਉਹ ਫੋਟੋ ਵਿੱਚ ਮਿਸਟਰੀ ਜਾ ਰੋਮਾਂਸ ਦਾ ਤੱਥ ਪੈਦਾ ਕਰ ਸਕਦਾ ਹੈ ਗਰਮੀ ਵਿੱਚ ਚਮਕਦਾ ਰੋਸ਼ਨੀ ਅਤੇ ਜੀਉ ਮੈਟ੍ਰਿਕ ਸ਼ੇਕ ਉਬਾਰੇ ਜਾ ਸਕਦੇ ਹਨ ਜੋ ਕੀ ਚਮਕੀਲੇ ਅਤੇ ਜੀਵਤ ਮੂਡ ਨੂੰ ਪ੍ਰਗਟ ਕਰਦੇ ਹਨ ਮੌਸਮ ਦੀ ਸਥਿਤੀ ਜਿਵੇਂ ਕੀ ਰੋਸ਼ਨੀ ਦਾ ਕੋਨਾ ਜਾਂ ਬੱਦਲ ਇਕ ਪੂਰੇ ਫੋਟੋਸ਼ੂਟ ਦੀ ਦਿਸ਼ਾ ਤੈਅ ਕਰ ਸਕਦੇ ਹਨ ਤੇ ਅੱਛੀਆਂ ਫੋਟੋਆਂ ਆਉਂਦੀਆਂ ਹਨ